ਪੰਜਾਬੀ ਸ਼ਬਦ ਸਿੰਧੂ ਨਦੀ ਦੀਆਂ ਪੰਜ ਪ੍ਰਮੁੱਖ ਪੂਰਵੀ ਸਹਾਇਕ ਨਦੀਆਂ ਦਾ ਹਵਾਲਾ ਦਿੰਦੇ ਹੋਏ ਪੰਜ ਪਾਣੀਆਂ ਲਈ ਫਾਰਸੀ ਸ਼ਬਦ ਪੰਜ ਆਵ ਤੋਂ ਲਿਆ ਗਿਆ ਹੈ ਇਸ ਖੇਤਰ ਦਾ ਨਾਮ ਦੱਖਣੀ ਏਸ਼ੀਆ ਦੇ ਧੁਰਕੋ ਫਾਰਸੀ ਜੇਤੂਆਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਨੁਵਾਦ ਸੀ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਜਿਸ ਵਿੱਚ ਪੂਰਾ ਪੰਜਾਬ ਵਸਦਾ ਹੈ ਇੱਥੇ ਵੱਖ ਵੱਖ ਤਰ੍ਹਾਂ ਦੇ ਲੋਕ ਮਿਲਦੇ ਹਨ ਪੰਜਾਬੀ ਬਹੁਤ ਹੀ ਵਧੀਆ ਸੁਭਾਅ ਦੇ ਮਿਲਣਸਾਰ ਲੋਕ ਹੁੰਦੇ ਹਨ ਪੰਜਾਬੀ ਲੋਕ ਹਰ ਇੱਕ ਦੀ ਸਹਾਇਤਾ ਕਰਦੇ ਹਨ ਪੰਜਾਬੀ ਲੋਕ ਕਿਤੇ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਹਰ ਇੱਕ ਥਾਂ 'ਤੇ ਪੰਜਾਬੀ ਭੱਜ ਕੇ ਜਾਂਦਾ ਹੈ ਪੰਜਾਬ ਵਿੱਚ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਹੈ ਜਿਵੇਂ ਕਿ ਇਸਾਈ ਹਿੰਦੂ ਸਿੱਖ ਮੁਸਲਿਮ ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਧਰਮ ਅਪਣਾਏ ਜਾਂਦੇ ਹਨ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਹਨ ਵੱਖ ਵੱਖ ਮੰਦਰ ਗੁਰਦੁਆਰੇ ਮਿਲਦੇ ਹਨ ਮੰਦਰਾਂ ਵਿੱਚ ਹਰ ਇੱਕ ਲੋਕ ਜਾਂਦੇ ਹਨ ਮੱਥਾ ਟੇਕਦੇ ਹਨ ਗੁਰਦੁਆਰਿਆਂ ਵਿੱਚ ਹਰ ਇੱਕ ਬੰਦਾ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਹੈ ਅਤੇ ਗੁਰਦੁਆਰੇ ਨੂੰ ਨਮਨ ਕਰਦਾ ਹੈ ਧੰਨਵਾਦ ਜੀ